ਗੁਰਵਿੰਦਰ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਮੈਂ ਐਮਾਜੋਨ ਤੋਂ ਇੱਕ ਬੂਟ ਲਏ ਸੀਗੇ ਐਡੀਡਾਸ ਦੇ ਯਾਰ ਬਹੁਤ ਵਧੀਆ ਬੂਟ ਸੀਗੇ ਅਤੇ ਬਹੁਤ ਸੋਹਣੇ ਬੂਟ ਨੇ ਅਤੇ ਮੈਂ ਤੈਨੂੰ ਵੀ ਕਹਿੰਦਾ ਤੂੰ ਵੀ ਮੰਗਵਾ ਲੈ ਅਤੇ ਉਹਨਾਂ 'ਤੇ ਆਫ਼ਰ ਵੀ ਚੱਲੀ ਜਾਂਦਾ ਫਿਫਟੀ ਪਰਸੈਂਟ ਅਤੇ ਜਿਹੜਾ ਉਹਨਾਂ ਦਾ ਸੋਲ ਹੈ ਨਾ ਸੋਲ ਉਹ ਬਹੁਤ ਸ਼ਾਨਦਾਰ ਹੈ ਅਤੇ ਉਹ ਬੂਟ ਮੈਂ ਪਾਏ ਅਤੇ ਵਧੀਆ ਚੱਲ ਰਹੇ ਨੇ ਅਤੇ ਮੈਨੂੰ ਐਂ ਲੱਗਦਾ ਵੀ ਇਹ ਬੂਟ ਘੱਟੋ ਘੱਟ ਜ਼ਿਆਦਾ ਨਹੀਂ ਤਿੰਨ ਚਾਰ ਸਾਲ ਚੱਲ ਪੈਣਗੇ ਅਤੇ ਆਏ ਵੀ ਕੁਛ ਜ਼ਿਆਦਾ ਪੈਸਿਆਂ ਦੇ ਨਹੀਂ ਸਿਰਫ 'ਤੇ ਸਿਰਫ ਅੱਠ ਸੌ ਰੁਪਏ ਦੇ ਆਏ ਨੇ ਵੈਸੇ ਇਹਨਾਂ ਦਾ ਸੌਲ੍ਹਾਂ ਸੌ ਰੁਪਏ ਰੇਟ ਸੀਗਾ ਅਤੇ ਇਹਨਾਂ ਨੇ ਫਿਫਟੀ ਪਰਸੈਂਟ ਡਿਸਕਾਊਂਟ ਕੀਤਾ ਹੋਇਆ ਸੀ ਅਤੇ ਅੱਠ ਸੌ ਦੇ ਹੀ ਰਹਿ ਗਏ ਨਾ ਫਿਰ ਅਤੇ ਅੱਠ ਸੌ ਰੁਪਏ ਦੇ ਵਿੱਚ ਐਡੀਡਾਸ ਦੇ ਬੂਟ ਆ ਗਏ ਬਹੁਤ ਸੋਹਣੇ ਬੂਟ ਨੇ ਅਤੇ ਕਲਰ ਇਹਨਾਂ ਦਾ ਬਲੈਕ ਹੈ ਅਤੇ ਹਲਕੀ ਵਿੱਚ ਵਾਈਟ ਪੱਟੀ ਹੈ ਅਤੇ ਮੈਂ ਤੈਨੂੰ ਵੀ ਕਹਿੰਦਾ ਤੂੰ ਵੀ ਮੰਗਵਾ ਲੈ ਐਡੀਡਾਸ ਨੇ ਬਹੁਤ ਸੋਹਣਾ ਆਫਰ ਦਿੱਤਾ ਹੋਇਆ ਅਤੇ ਇਹ ਸ਼ਾਮ ਤੱਕ ਹੀ ਹੈ ਆਫਰ ਉੱਦੂ ਬਾਅਦ ਇਸ ਆਫਰ ਨੇ ਖਤਮ ਹੋ ਜਾਣਾ ਅਤੇ ਤੂੰ ਵੀ ਜਲਦੀ ਤੋਂ ਜਾ ਐਮਾਜ਼ੋਨ ਦੀ ਸਾਈਟ ਦੇ ਉੱਤੇ ਅਤੇ ਇਹ ਆਰਡਰ ਕਰ ਅਤੇ ਇਹ ਬੂਟ ਮੰਗਵਾ ਬੂਟ ਬਹੁਤ ਹੀ ਸ਼ਾਨਦਾਰ ਅਤੇ ਵਧੀਆ ਇੱਥੇ ਇਹਦਾ ਤਲਾ ਜਿਹੜਾ ਉਹ ਹੋਰ ਵੀ ਵਧੀਆ ਉਹ ਤੁਸੀਂ ਜਿੰਨਾ ਮਰਜ਼ੀ ਤੁਰ ਲਓ ਬਿਲਕੁਲ ਵੀ ਤੁਹਾਨੂੰ ਥਕਾਵਟ ਨਹੀਂ ਹੁੰਦੀ ਠੀਕ ਆ ਮੇਰਾ ਵੀਰ ਓਕੇ